ਸਤਿ ਸ਼੍ਰੀ ਅਕਾਲ ਵੀਰੇ ਵਧੀਆ ਜੀ ਵਧੀਆ ਕਿਰਪਾ ਕੌਣ ਜੀ ਹਾਂਜੀ ਬੋਲੋ ਜੀ ਠੀਕ ਹੈ ਜੀ ਵੀਰੇ ਹੁਣ ਤਾਂ ਨਾ ਆ ਦਿਵਾਲੀ ਕਰਕੇ ਕਾਫੀ ਫੋਨ ਤੇ ਓਫੇਰ ਚੱਲ ਰਹੀਆਂ ਨੇ ਤੁਸੀਂ ਕਿਹੜਾ ਫੋਨ ਲੈਣਾ ਚਾਹੁੰਦੇ ਨੇ ਕੈਮਰਾ ਕੁਆਲਟੀ ਬ੍ਰਾਂਡ ਜਿਹੜਾ ਮਰਜੀ ਹੋ ਜੇ

ਜੈ ਤੁਸੀਂ ਜਿਆਦਾ ਪੈਸੇ ਨਹੀਂ ਲਾਉਣਾ ਚਾਉਂਦੇ ਫੋਨ ਸੈਮਸੰਗ ਵਿਚ ਆਉਂਦਾ ਮਾਡਲ ਨੰਬਰ ਐਮ ਪੰਦਰਾ ਹਾਂਜੀ ਦਸ ਹਜ਼ਾਰ ਓਹਦੇ ਵਿੱਚ ਤੁਹਾਨੂੰ ਛੇ ਜੀ ਬੀ ਰੈਮ ਤੇ ਇਕ ਸੋ ਅਠਾਈ ਜੀ ਬੀ ਸਟੋਰੇਜ ਮਿਲ ਜੇਗੀ ਡਿਸਪਲੇਅ ਸਿੰਪਲ ਹੋਵੇਗੀ ਕੈਮਰਾ ਠੀਕ ਹੋਗਾ ਐਵਰੇਜ ਹੋਏਗਾ ਬਹੁਤ ਵਧੀਆ ਵੀ ਨਹੀ ਚਲੋ ਕੋਈ ਗੱਲ ਨੀ ਅਸੀਂ ਯੂਥ ਕਰੋਗੇ ਸਿੰਪਲ ਭੇਜਾ ਇਕ ਵਾਰੀ ਸੈਪਲ ਸ਼ੋਪ ਤੇ ਕਦੋਂ ਆ ਰਹੇ ਹੋ ਠੀਕ ਹੈ ਜੀ ਚਲੋ ਮੈਂ ਇਦਾਂ ਚਲੋ ਮੈਂ ਇਦਾਂ ਕਰਦਾ ਮੈਂ ਨਾ ਕੁਝ ਫੋਨ ਤੇ ਵੀਡੀਓ ਸੈਂਡ ਕਰ ਦੇਣਾ ਤੁਸੀਂ ਵੀਡੀਓ ਚੈੱਕ ਕਰ ਲਿਓ ਜੇ ਆਪਾਂ ਵਧੀਆ ਲੱਗੇ ਤੇ ਉਹ ਦੇਖ ਲਿਓ ਜੀ ਕੈਮਰਾ ਤੁਹਾਡੀ ਕਿੰਨਾ ਹੋ ਜਾਂਦੀ ਇਹ ਤੁਹਾਡੇ ਤੇ ਡੀਪੇੰਡ ਕਰਦਾ ਤੇ ਕੰਮ ਕੀ ਕਰਦੇ ਤੁਸੀਂ ਕੰਮ ਕੀ ਹੈ ਤੁਹਾਡਾ ਅੱਛਾ ਅੱਛਾ ਕੈਮਰਾ ਵੀ ਵਧੀਆ ਚਾਹੀਦਾ

ਚਲੋ ਕੋਈ ਗੱਲ ਨਹੀਂ ਮਿਲ ਜਾਏਗੀ ਚਲੋ ਕੋਈ ਗੱਲ ਨਹੀਂ ਮੈਨੂੰ ਤਾਂ ਕੁਝ ਵੀਡੀਓ ਬਣਾ ਕੇ ਸੈਂਡ ਕਰਦਾ ਥੋੜਾ ਦਿਓ ਮੈਨੂੰ ਮੈਂ ਕੁਝ ਵੀਡੀਓ ਬਣਾ ਕੇ ਸੈਡ ਕਰਦਾ ਤੁਸੀਂ ਵੀਡੀਓ ਚੈੱਕ ਕਰ ਲਿਆ ਜੇ ਬਾਕੀ ਜਦੋਂ ਤੈਨੂੰ ਚੰਗਾ ਲੱਗੇ ਫੋਨ ਵਧੀਆ ਲੱਗਦਾ ਜੀ ਤੇ ਮੈਂ ਦੀ ਡਿਸਪਲੇ ਵਗੈਰਾ ਕੀ ਕੁਆਲਿਟੀ ਦੇ ਵਿੱਚ ਕਿ ਉਸ ਤੋਂ ਨੇ ਪੈਸੇ ਨੇ ਕੈਮਰਾ ਦਾ ਕਿੱਦਾਂ ਕਿੰਨੇ ਪਏਗਾ ਸਕੀਮ ਕੀ ਚੱਲ ਰਹੀ ਸੀ ਆਫਰ ਕੀ ਚਲਦੀ ਹੈ ਸਾਰਾ ਕੁਝ ਬਾਅਦ ਵਿਚ ਦਸ ਦਿਆਂਗਾ ਤੇ ਤੁਸੀਂ ਫਿਰ ਮਨ ਬਣਾ ਕੇ ਜਦੋ ਮਰਜੀ ਆਇਓ ਠੀਕ ਹੈ ਵੀਰੇ ਸ਼ੁਕਰੀਆ